ਬਾਈ ਦੇਖੋ ਸਾਰੇ ਭਾਰਤ 'ਚ ਥਾਂ ਥਾਂ ਪੂਜਾ ਦੇ ਸਥਾਨ ਹੈਗੇ ਹੈ ਮੱਥਾ ਟੇਕਣ ਨੂੰ ਬਾਕੀ ਜੇ ਮੇਰੇ ਜ਼ਿਲ੍ਹੇ ਦੀ ਗੱਲ ਕਰੋ ਇੱਥੇ ਵੀ ਖਾਸੇ ਹੈ ਪਰ ਥੋੜ੍ਹੇ ਜਿਹੇ ਜ਼ਿਆਦਾ ਹੀ ਮਸ਼ਹੂਰ ਹੈ ਇੱਕ ਤਾਂ ਹੈਗਾ ਕੁਰਾਲੀ ਉੱਥੇ ਸ਼ੀਤਲਾ ਮਾਤਾ ਦਾ ਮੰਦਿਰ ਜਦ ਮਾਤਾ ਦੇ ਦਿਨ ਆਉਂਦੇ ਹੈ ਉੱਥੇ ਮੱਥੇ ਮੁੱਥੇ ਟੇਕ ਹੁੰਦੇ ਹੈ ਧੱਕਾ ਖੜਕਦਾ ਬਾਈ ਪੂਰਾ ਉੱਥੇ ਉੱਥੇ ਗੁੱਲਗੁਲੇ ਕਚੌਰੀਆਂ ਚੜ੍ਹਦੀਆਂ ਹੁੰਦੀਆਂ ਛੋਲੇ ਛੂਲੇ ਵੀ ਚੜ੍ਹਦੇ ਹੈ ਫਿਰ ਉੱਥੇ ਇੱਕ ਹੋਰ ਪਰੰਪਰਾ ਵੀ ਹੈ ਪਤਾ ਨਹੀਂ ਉਹਦਾ ਕੀ ਹੈ ਕੀ ਨਹੀਂ ਸਿਰ ਪਾ ਨੂੰ ਮੁਰਗਾ ਜਿਹਾ ਛੁਹਾਉਂਦੇ ਹੁੰਦੇ ਹੈ ਬਸ ਐਨਾ ਕੁ ਪਤਾ ਸਾਨੂੰ ਤਾਂ ਵੀ ਦਸ ਰੁਪਏ ਦੋ ਸਿਰ ਪ ਨੂੰ ਮੁਰਗਾ ਛੂਹਾ ਦਿੰਦੇ ਹੈ ਉਹਦਾ ਕੀ ਹੈ ਮਤਲਬ ਬਣਦਾ ਉਹ ਸਾਨੂੰ ਕੋਈ ਨਹੀਂ ਪਤਾ ਹੈ ਇਹਦੇ ਤੋਂ ਇਲਾਵਾ ਇੱਕ ਦਾਊਂ ਸਾਹਿਬ ਹੈ ਇਹ ਜਮ੍ਹਾਂ ਮੋਹਾਲੀ ਸ਼ਹਿਰ ਦੀ ਜੜ੍ਹ 'ਚ ਹੈ ਉੱਥੇ ਵੀ ਸਿੱਖ ਧਰਮ ਨਾਲ਼ ਸੰਬੰਧਿਤ ਗੁਰਦੁਆਰਾ ਹੈ ਉੱਥੇ ਵੀ ਕਾਫ਼ੀ ਹਰੇਕ ਐਤਵਾਰ ਨੂੰ ਹੀ ਰੱਸ਼ ਹੁੰਦਾ ਹੈ ਉਹਦੇ ਤੋਂ ਇਲਾਵਾ ਪਿੰਡ ਖਿਦਰਾਬਾਦ ਹੈ ਜਿਹੜਾ ਕਿ ਮੇਰੇ ਪਿੰਡ ਦੇ ਲਾਗੇ ਹੈ ਉੱਥੇ ਬਾਈ ਹਰੇਕ ਸਾਲ ਹੌਲਾ ਮਹੱਲਾ ਹੁੰਦਾ ਹੈ ਇੱਥੇ ਦਾ ਇਤਿਹਾਸ ਜਾਣੀ ਕਿ ਐਵੇਂ ਮੰਨਿਆ ਜਾਂਦਾ ਵੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਆ ਕੇ ਗਏ ਨੇ ਜਿਹਦੇ ਕਰਕੇ ਉੱਥੇ ਗੁਰਦੁਆਰਾ ਦਮਦਮਾ ਸਾਹਿਬ ਬਣਾਇਆ ਗਿਆ ਹੈ ਉੱਥੇ ਹਰੇਕ ਸਾਲ ਮਾਰਚ ਮਹੀਨੇ ਦੇ ਗੇੜ ਦੇ ਵਿੱਚ ਹੌਲਾ ਮਹੱਲਾ ਭਰਦਾ ਹੈ ਜਾਣੀ ਕਿ ਜਿਹੜਾ ਇਹ ਆਨੰਦਪੁਰ ਸਾਹਿਬ ਵਾਲਾ ਵੀ ਹੌਲਾ ਮਹੱਲਾ ਇਹਦੇ ਤੋਂ ਪਹਿਲਾਂ ਆਉਂਦਾ ਹੈ ਜਾਣੀ ਕਿ ਐਂਵੇ ਮੰਨਿਆ ਜਾਂਦਾ ਵੀ ਸ਼ੁਰੂਆਤ ਉੱਥੇ ਤੋਂ ਹੁੰਦੀ ਹੌਲੇ ਮਹੱਲੇ ਦੀ ਉਹਦੇ ਤੋਂ ਬਾਅਦ ਫਿਰ ਬਾਕੀ ਪਾਸੇ ਆਉਂਦਾ ਹੈ ਅਤੇ ਬਾਕੀ ਇੱਕ ਸਿਸਮਾਂ ਪਿੰਡ ਹੈ ਥੋੜ੍ਹਾ ਪਹਾੜੀਆਂ ਜਿਹੀ 'ਚ ਜਾ ਕੇ ਹੈ ਮੋਹਾਲੀ ਜ਼ਿਲ੍ਹੇ 'ਚ ਹੀ ਆਉਂਦਾ ਹੈ ਇੱਥੇ ਭੈਰੋ ਦਾ ਮੰਦਿਰ ਹੈ ਉੱਥੇ ਦਾਰੂ ਵੀ ਬਹੁਤ ਚੜ੍ਹਦੀ ਹੈ ਬਾਕੀ ਇੰਨਾ ਕੁ ਜਾਣੀ ਕਿ ਮੈਨੂੰ ਮੇਨ ਮੇਨ ਪਤਾ ਹੈ